ਸਰਕਾਰ ਦੁਆਰਾ ਲੋੜਵੰਦਾਂ ਦੇ ਲਈ ਕਈ ਸਾਰੇ ਉਪਰਾਲੇ ਸੇ ਉਹਨਾਂ ਦੀ ਸਿਹਤ ਦੇ ਲਈ ਕਈ ਸਾਰੀ ਪਹਿਲ ਕਦਮੀਆਂ ਚਲਾਈਆਂ ਗਈਆਂ ਹਨ ਜਿਵੇਂ ਕਿ ਗਰੀਬ ਔਰਤਾਂ ਦੇ ਲਈ ਜੱਚਾ ਬੱਚਾ ਯੋਜਨਾ ਅਤੇ ਪ੍ਰਧਾਨ ਮੰਤਰੀ ਬੀਮਾ ਯੋਜਨਾ ਸਕੀਮ ਜਿਸ ਦੇ ਅਧੀਨ ਲੋਕਾਂ ਨੂੰ ਪੰਜ ਲੱਖ ਤੱਕ ਦਾ ਮੁਫਤ ਇਲਾਜ ਦਿੱਤਾ ਜਾਂਦਾ ਹੈ ਹੁਣ ਸਾਡੇ ਰੋਪੜ ਦੇ ਵਿੱਚ ਜੇ ਅਸੀਂ ਇਹ ਕਾਰਡ ਜੋ ਕਿ ਜਿਹਨੂੰ ਆਪਾਂ ਸ ਸਟਾਰ ਹੈਲਥ ਇਨਸ਼ੋਰੈਂਸ ਕਾਰਡ ਬੋਲਦੇ ਹਾਂ ਅਸੀਂ ਉਹ ਬਣਵਾਉਣਾ ਹੋਵੇ ਤਾਂ ਸ ਸਾਨੂੰ ਡੀ ਏ ਵੀ ਸਕੂਲ ਦੇ ਕੋਲ ਜਿਹੜੀ ਡੀ ਏ ਵੀ ਵਾਲੀ ਸੜਕ ਹੈ ਉੱਥੇ ਸਟਾਰ ਹੈਲਥ ਇਨਸ਼ੋਰੈਂਸ ਦੀ ਦੁਕਾਨ ਹੈ ਅਸੀਂ ਉੱਥੇ ਜਾ ਕੇ ਆਪਣੀ ਜਾਣਕਾਰੀ ਦੇ ਕੇ ਆਪਣਾ ਕਾਰਡ ਬਣਵਾ ਸਕਦੇ ਹਨ ਅਤੇ ਇਹ ਕਾਰਡ ਮੁੱਖ ਤੌਰ 'ਤੇ ਉਹਨਾਂ ਗਰੀਬ ਲੋਕਾਂ ਲਈ ਜੋ ਕਿ ਪਛੜੀ ਸ਼੍ਰੇਣੀ ਨੂੰ ਦੇ ਵਿੱਚ ਆਉਂਦੇ ਹਨ ਅਤੇ ਉਹਨਾਂ ਦੇ ਲਈ ਹੀ ਇਹ ਕਾਰਡ ਜੋ ਕਿ ਬਟ ਸਰਕਾਰ ਦੁਆਰਾ ਚਲਾਇਆ ਗਿਆ ਹੈ